ਹਾਂਜੀ ਸਰ ਮੈਂ ਤਰਨਦੀਪ ਕੌਰ ਬੋਲ ਰਹੀ ਹਾਂ ਹੁਣ ਤੁਸੀਂ ਮੈਨੂੰ ਡਰੋਪ ਕੀਤਾ ਇੱਥੇ ਧਰਮਪੁਰਾ ਬਾਜ਼ਾਰ ਦੇ ਕੋਲ ਹਾਂਜੀ ਹਾਂਜੀ ਤੁਸੀਂ ਰਮੇਸ਼ ਬੋਲ ਰਹੇ ਹੋ ਨਾ ਉਬਰ ਡਰਾਈਵਰ ਹਾਂਜੀ ਐਕਚੁਲੀ ਜਦ ਮੈਂ ਉੱਤਰੀ ਤਾਂ ਮੈਂ ਦੇਖਿਆ ਵੀ ਮੇਰੇ ਬੈਗ 'ਚ ਮੇਰਾ ਉਹ ਨਹੀਂ ਸੀਗਾ ਮੇਰਾ ਕੈਸ਼ ਬੈਗ ਹਾਂਜੀ ਹਾਂਜੀ ਮੇਰਾ ਵੋਲਟ ਨਹੀਂ ਸੀਗਾ ਉਹਦੇ ਅੰਦਰ ਅੱਛਾ ਨਹੀਂ ਮੈਂ ਨਹੀਂ ਨਹੀਂ ਤੁਸੀਂ ਇੱਕ ਵਾਰੀ ਪਲੀਜ਼ ਦੇਖ ਲਉ ਪਲੀ ਮੈਂ ਸ਼ਾਇਦ ਗੱਡੀ ਦੇ ਵਿੱਚ ਬੈਠੀ ਸੀ ਤਾਂ ਜਦ ਮੈਂ ਉੱਤਰੀ ਤਾਂ ਸ਼ਾਇਦ ਉਹ ਸੀਟ ਦੇ ਥੱਲੇ ਨਾ ਗਿਰ ਗਿਆ ਹੋਵੇ ਉਹਦੇ ਅੰਦਰ ਮੇਰਾ ਐਕਚੁਲੀ ਨਾ ਬਹੁਤ ਇੰਪੋਰਟੈਂਟ ਸਮਾਨ ਹੈ ਮੇਰਾ ਆਧਾਰ ਕਾਰਡ ਮੇਰਾ ਕ੍ਰੈਡਿਟ ਕਾਰਡ ਅਤੇ ਹੋਰ ਦੋ ਤਿੰਨ ਚੀਜ਼ਾਂ ਨੇ ਉਸਦੇ ਅੰਦਰ ਅਤੇ ਆਈ ਵਿਲ ਬੀ ਵੈਰੀ ਥੈਂਕਫੁਲ ਜੇ ਤੁਸੀਂ ਇੱਕ ਵਾਰੀ ਦੇਖ ਲਉ ਪਲੀਜ਼ ਜੀ ਮੈਨੂੰ ਪਤਾ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਨਹੀਂ ਮੁੜ ਸਕਦੇ ਵਾਪਸ ਜਾਂ ਤੁਹਾਡੇ ਬੈਲੈਂਸ ਵਿੱਚ ਐਡ ਹੋ ਜਾਵੇਗਾ ਉਹ ਚੀਜ਼ ਪਰ ਮੈਨੂੰ ਮੇਰਾ ਜਿਹੜਾ ਵੋਲਟ ਆ ਬਹੁਤ ਜ਼ਰੂਰੀ ਹੈ ਜਾਂ ਤਾਂ ਤੁਸੀਂ ਮੈਨੂੰ ਕਿਸੇ ਤਰੀਕੇ ਦਾ ਕੋਈ ਕਸਟਮਰ ਕੈਬ ਸਰਵਿਸ ਦੱਸ ਦਿਉ ਵੀ ਅੱਛਾ ਤਾਂ ਮੈਨੂੰ ਕੈਬ ਪ੍ਰੀ ਬੁਕ ਕਰਨੀ ਪਵੇਗੀ ਨਹੀਂ ਮਤਲਬ ਕਸਟਮਰ ਕੇਅਰ ਜਾਂ ਸਮਥਿੰਗ ਦੇ ਨਾਲ ਨਹੀਂ ਕਰ ਸਕਦੇ ਆਪਾਂ ਹਾਂਜੀ ਕੋਂਟੈਕਟ ਕਰ ਸਕਦੇ ਹਾਂ ਠੀਕ ਹੈ ਹਾਂਜੀ ਪਲੀਜ਼ ਤੁਸੀਂ ਮੈਨੂੰ ਉਸਦਾ ਨੰਬਰ ਵਟਸਐਪ 'ਤੇ ਸੈਂਡ ਕਰ ਦਿਉ

ਹਾਂਜੀ ਥੈਂਕ ਯੂ ਸੋ ਮੱਚ ਆਈ ਵਿਲ ਬੀ ਵੈਰੀ ਥੈਂਕਫੁਲ